ਸਤਿ ਸ਼੍ਰੀ ਅਕਾਲ ਜੀ ਮੈਂ ਕਾਰਤਿਕ ਬੋਲ ਰਿਹਾ ਸਾਡੇ ਭਾਰਤ ਦੀ ਖੇਡਾਂ ਅੰਤਰਰਾਸ਼ਟਰੀ ਖੋ ਖੋ ਅਤੇ ਕਬੱਡੀ ਕਾਫ਼ੀ ਕਾਫ਼ੀ ਹਾਈ ਲੈਵਲ 'ਤੇ ਖੇਡੀ ਜਾਂਦੀਆਂ ਔਰ ਇਹ ਦੇਖਣ ਦੇਖਣ ਲਈ ਵੀ ਕਾਫ਼ੀ ਦਰਸ਼ਕ ਉਤਸੁਕ ਹੁੰਦੇ ਹਨ ਇਹ ਕਬੱਡੀ ਜਿਹੜੀ ਆ ਸਾਡੀ ਅੰਤਰਰਾਸ਼ਟਰੀ ਖੇਡ ਡਿਸਟਰਿਕਟ ਲੈਵਲ 'ਤੇ ਹਾਈ ਲੈਵਲ 'ਤੇ ਵੀ ਹੋਣੀ ਚਾਹੀਦੀ ਆ ਅੰਤਰਰਾਸ਼ਟਰੀ ਲੈਵਲ 'ਤੇ ਕਿਉਂਕੀ ਕਬੱਡੀ ਵਿੱਚ ਕਾਫ਼ੀ ਕਾਫ਼ੀ ਦਿਲਚਸਪ ਦਿਲਚਸਪ ਖੇਡ ਹੈਗੀ ਹੈ ਇਹ ਇਹ ਭਾਰਤ ਦੀ ਕਾਫ਼ੀ ਵਧੀਆ ਖੇਡ ਹੈ ਇਸ ਹਰਿਆਣੇ ਵਿੱਚ ਹਰਿਆਣੇ ਵਿੱਚ ਕਾਫ਼ੀ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਇਸ ਖੇਡ ਨੂੰ ਕਿਉਂਕਿ ਕਬੱਡੀ ਕਬੱਡੀ ਜੋ ਖੇਡ ਹੈ ਸਾਡੇ ਕਾਫ਼ੀ ਫ਼ਾਇਦੇਮੰਦ ਆ ਇਸ ਇਸ ਨਾਲ ਅਸੀਂ ਆਪਣੇ ਦੁਸ਼ਮਣਾਂ ਨੂੰ ਵੀ ਕੁਝ ਦਾਅ ਪਾ ਕੇ ਹਰਾ ਸਕਦੇ ਹਾਂ ਔਰ ਇਸਦੇ ਵੀ ਸਾਡੇ ਵੀ ਮੁਹੱਲੇ ਵਿੱਚ ਕਬੱਡੀ ਹੋਈ ਸੀ ਜਿਸ ਨਾਲ ਜਿਸਦਾ ਇਨਾਮ ਟਰੈਕਟਰ ਨੂੰ ਰੱਖਿਆ ਗਿਆ ਸੀ ਔਰ ਉੱਥੇ ਕਾਫ਼ੀ ਦੂਰੋਂ ਦੂਰੋਂ ਕਬੱਡੀ ਦੇ ਪਲੇਅਰ ਆਏ ਸਨ ਔਰ ਕਾਫ਼ੀ ਮਨੋਰੰਜਨ ਦਾਇਕ ਖੇਡ ਬਣੀ ਸੀ ਉਸ ਦਿਨ ਔਰ ਖੋ ਖੋ ਵੀ ਸਾਡੀ ਕਾਫ਼ੀ ਵਧੀਆ ਖੇਡ ਹੈਗੀ ਹੈ ਪਰ ਇਸ ਵਿੱਚ ਜ਼ਿਆਦਾਤਰ ਲੜਕੀਆਂ ਹੀ ਹਿੱਸਾ ਲੈਂਦੀਆਂ ਹਨ ਕਿਉਂਕਿ ਇਹ ਲੜਕੀਆਂ ਲਈ ਬਣਾਈ ਗਈ ਹੈ ਲੜਕੀਆਂ ਦੀ ਹੀ ਜ਼ਿਆਦਾ ਲੜਕੀਆਂ ਦੀ ਖੇਡ ਹੈਗੀ ਹੈ ਔਰ ਇਹ ਇਹ ਕਾਫ਼ੀ ਹਸੇ ਲ ਹੱਸੇ ਹਾਸੇ ਮਜਾਕ ਵਾਲੀ ਖੇਡ ਆ ਔਰ ਕਾਫ਼ੀ ਦਿਲਚਸਪ ਖੇਡ ਹੈਗੀ ਹੈ ਲੜਕੀਆਂ ਦੀ ਔਰ ਇਹਨਾਂ ਦੋਨਾਂ ਨੂੰ ਅੰਤਰਰਾਸ਼ਟਰੀ ਡਿਸਟ੍ਰਿਕਟ ਲੈਵਲ 'ਤੇ ਹਾਈ ਲੈਵਲ 'ਤੇ ਖੇਡਣਾ ਚਾਹੀਦਾ ਹੈ ਔਰ ਇਹਨਾਂ ਨੂੰ ਹੋਰ ਮਾਨਤਾ ਦੇਣੀ ਜਾਂਦੀ ਆ ਅੰਤਰਾਸ਼ਟਰੀ ਲੈਵਲ 'ਪੱਧਰ ਤੇ ਵੀ ਵਧੇਰੇ ਹੋਰ ਮਾਨਤਾ ਦੇਣੀ ਚਾਹੀਦੀ ਹੈ ਇਹਨਾਂ ਦੋਨਾਂ ਖੇਡਾਂ ਨੂੰ ਕਿਉਂਕਿ ਇਹ ਭਾਰਤ ਦੀ ਖੇਡਾਂ ਹਨ ਧੰਨਵਾਦ